ਹੈਲੋ ਮੈਂ ਜਸਵਿੰਦਰ ਕੌਰ ਸਰ ਮੈਂ ਇਸ ਲਈ ਫੋਨ ਕੀਤਾ ਸੀ ਤੁਹਾਨੂੰ ਕਿ ਮੈਂ ਆਪਣੇ ਜਿਹੜੇ ਬੈਂਕ ਅਕਾਊਂਟ ਦਾ ਔਟੋ ਕਟ ਹੈ ਉਹ ਮੈਂ ਬੰਦ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਕਈ ਵਾਰ ਮੇਰੀ ਗੈਰ ਮੌਜੂਦਗੀ ਦੇ ਵਿੱਚ ਜਾਂ ਮੇਰੇ ਫਰੈਂਡਸ ਔਰਡਰ ਕਰ ਦਿੰਦੇ ਹੈ ਅਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਮੇਰੇ ਪੈਸੇ ਹੁੰਦੇ ਆ ਉਹ ਔਟੋ ਕੱਟ ਹੋ ਜਾਂਦੇ ਹੈ ਇਸ ਚੀਜ਼ ਦੇ ਲਈ ਮੈਂ ਜਿਹੜਾ ਔਟੋ ਕੱਟ ਹੈ ਉਹ ਬੰਦ ਕਰਵਾਉਣਾ ਚਾਹੁੰਦੀ ਹਾਂ ਤਾਂ ਕਿ ਮੈਨੂੰ ਇਹ ਪਤਾ ਚੱਲਦਾ ਰਹੇ ਕਿ ਮੇਰੇ ਬੈਂਕ ਬੈਲੈਂਸ ਦੇ ਵਿੱਚ ਕਿੰਨੇ ਪੈਸੇ ਹੈ ਅਤੇ ਕਿੱਥੇ ਉਹ ਕੱਟ ਹੋ ਰਹੇ ਹੈ ਅਤੇ ਮੈਨੂੰ ਕੋਈ ਜਿਹੜੀ ਪ੍ਰੋਬਲਮ ਹੈ ਉਹ ਨਾ ਆਵੇ ਜਿਹੜੀ ਹੁਣ ਔਟੋ ਕੱਟ ਕਰਕੇ ਆ ਰਹੀ ਹੈ ਬਾਕੀ ਤੁਹਾਡੀਆਂ ਬੈਂਕ ਸਰਵਿਸਸ ਬਹੁਤ ਅੱਛੀ ਹੈ ਅਤੇ ਬਹੁਤ ਪੋਜੀਟਿਵ ਫੀਡਬੈਕ ਹੈ ਉਸ ਚੀਜ਼ ਦੇ ਰਿਲੇਟਿਡ ਬਸ ਮੈਨੂੰ ਇਹੀ ਚੀਜ਼ ਦੀ ਪ੍ਰੋਬਲਮ ਆ ਰਹੀ ਸੀਗੀ ਇੱਕ ਜਿਹੜੇ ਮੇਰੇ ਪੈਸੇ ਹੈ ਕਿ ਉਹ ਔਟੋਮੈਟਿਕਲੀ ਕੱਟ ਹੋ ਜਾਂਦੇ ਆ ਪਲੀਜ਼ ਤੁਸੀਂ ਉਹਨਾਂ ਨੂੰ ਬੰਦ ਕਰ ਦਿਉ